ਰੰਗੋਲੀ ਸਜਾਉਣੀ ਕਈ ਇਲਾਕਿਆਂ ਦੇ ਵਿੱਚ ਚੱਲਦੀ ਆ ਚਲਾਉਂਦੇ ਹਾਂ ਪਰ ਸੂਰਜ ਨੂੰ ਪਾਣੀ ਚੜਾਉਣਾ ਇਹ ਤਾਂ ਮੂਰਖ ਮਤ ਹੀ ਆ ਸੂਰਜ ਤੱਕ ਪਾਣੀ ਕਦੇ ਜਾਊਗਾ ਮੱਥੇ 'ਤੇ ਸੰਧੂਰ ਲਗਾਉਣਾ ਇਹ ਸਤੀਆ ਦਾ ਕੰਮ ਆ ਜੋ ਕਿ ਜਿਸ ਦਾ ਧੀ ਭੈਣ ਦਾ ਬੇਟੀ ਦਾ ਵਿਆਹ ਹੋ ਗਿਆ ਉਹਨੇ ਤਾਂ ਸੰਧੂਰ ਲਗਾਉਣਾ ਹੀ ਲਗਾਉਣਾ ਪਵਿੱਤਰ ਧਾਗਾ ਇਹ ਕਿਹੜਾ ਹੁੰਦਾ ਪਵਿੱਤਰ ਧਾਗਾ ਕਿੱਥੋਂ ਆਉਂਦਾ ਮੇਰੇ ਵਰਗੇ ਲੰਡੇ ਭੂਪ ਨੇ ਸਾਧ ਨੇ ਜਿਹੜੇ ਉਹ ਕ ਕ ਗੱਲ ਉਹ ਹੀ ਧਾਗਾ ਪਵਾ ਲਉ ਜੀ ਤੁਹਾਡਾ ਬੁਖਾਰ ਉਤਰੂ ਫਲਾਣਾ ਇਹ ਗਲਤ ਗੱਲ ਹੈ ਜੀ ਕੋਈ ਉਹ ਨਹੀਂ ਪੂਜਾ ਲਈ ਮੰਦਰ ਜਾਣਾ ਚਲੋ ਪਹਿਲਾਂ ਤੋਂ ਚੱਲਦੀ ਆਈ ਆ ਬਜ਼ੁਰਗਾਂ ਤੋਂ ਪੂਜਾ ਵਾਸਤੇ ਮੰਦਰ ਜਾਣਾ ਚਾਹੀਦਾ ਠੀਕ ਹੈ ਦਰਗਾਹ 'ਤੇ ਵੀ ਜਾਣਾ ਚਾਹੀਦਾ ਵਰਤ ਰੋਜ਼ਾ ਜਿਹੜਾ ਵਰਤ ਆ ਜਾਂ ਰੋਜ਼ਾ ਰੱਖਦੇ ਹਾਂ ਇਹਦਾ ਵੀ ਇੱਕ ਕਾਰਨ ਆ ਬਹੁਤ ਵੱਡਾ ਇਹਦਾ ਇਹ ਕਾਰਨ ਆ ਵੀ ਆਪਣਾ ਜਿਹੜਾ ਸਰੀਰ ਆ ਉਹਨੂੰ ਰੈਸਟ ਮਿਲੇ ਅੰਦਰਲੇ ਨਾਲੀ ਤੰਤਰ ਨੂੰ ਰੈਸਟ ਮਿਲੂਗੀ ਸਰੀਰ ਨੂੰ ਜੇ ਆਪਾਂ ਖਾਈ ਜਾਵਾ ਖਾਈ ਜਾਵਾ ਖਾਈ ਜਾਵਾ ਢਿੱਡ ਭਰਜੂਗਾ ਅੰਦਰ ਪਾਚਣ ਸ਼ਕਤੀ ਘੱਟ ਕੰਮ ਕਰਦੀ ਹੋਊ ਕਿਸੇ ਦੀ ਜਾਂ ਪਾਚਣ ਸ਼ਕਤੀ ਰੁੱਕ ਜੂਗੀ ਤਾਂ ਆਪਾਂ ਫਿਰ ਬਿਮਾਰ ਹੋਵਾਂਗੇ ਪਰੇਸ਼ਾਨ ਹੋਵਾਂ ਇਸ ਕਰਕੇ ਜਦੋਂ ਵਰਤ ਰੱਖਿਆ ਹੋਊਗਾ ਅੰਦਰ ਤਾਂ ਜਿਹੜਾ ਅੰ ਅੰਦਰਲਾ ਸਿਸਟਮ ਆ ਸਾਰਾ ਉਹ ਸੈਟ ਸੈੱਟ ਰਹਿੰਦਾ ਬੰਦੇ ਦਾ ਬਿਮਾਰ ਹੋਣ ਦਾ ਚਾਨਸ ਨੇ ਜਿਹੜੇ ਉਹ ਬਹੁਤ ਘੱਟ ਜਾਂਦੇ ਨੇ ਬਾਕੀ ਧਾਰਮਿਕ ਰੀਤਾਂ ਨੇ ਜਿਹੜਾ ਇਹਦਾ ਮਹੱਤਤਾ ਤਾਂ ਇਹੀ ਆ ਵੀ ਜਿਵੇਂ ਸਾਡੇ ਬਜ਼ੁਰਗ ਕਰਦੇ ਆਏ ਉਵੇਂ ਹੀ ਅਸੀਂ ਕਰਦੇ ਆ ਖਾਮਖਾਹ ਧਾਰਮਿਕ ਰੀਤਾਂ ਨੂੰ ਮੈਂ ਕੋਈ ਉਹ ਪ੍ਰਿਓਰਟੀ ਨਹੀਂ ਦਿੰਦਾ ਜੀ